ਭੰਗੜੇ ਤੇ ਪ੍ਰਦਰਸ਼ਨ ਲਈ ਕੁੜਤਾ ਚਾਦਰਾ ਪਾਇਆ ਜਾਂਦਾ ਹੈ ਤੇ ਸਿਰ ਉੱਤੇ ਮਾਵੇ ਵਾਲੀ ਪੱਗ ਬੰਨੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਸਜਾਵਟ ਲਈ ਗਹਿਣੇ ਵੀ ਪਾਏ ਜਾਂਦੇ ਹਨ ਕਈ ਮੁੰਡੇ ਕੰਨਾਂ ਵਿੱਚ ਮੁੰਦਰਾਂ ਵੀ ਪਾ ਲੈਂਦੇ ਹਨ ਤੇ ਗਲ ਵਿੱਚ ਕੈਂਠਾ ਪਾਇਆ ਜਾਂਦਾ ਹੈ ਤੇ ਗੁੱਟਾਂ ਉੱਤੇ ਗਾਨੇ ਵੀ ਬੰਨ ਲਏ ਜਾਂਦੇ ਹਨ ਇਸ ਤੋਂ ਇਲਾਵਾ ਕਈ ਵਾਰ ਪੈਰਾਂ ਦੇ ਵਿੱਚ ਘੁੰਗਰੂ ਵੀ ਪਾ ਲਏ ਜਾਂਦੇ ਹਨ ਇਹ ਸਭ ਕੁਛ ਭੰਗੜਾ ਪਾਉਣ ਵਾਲੇ ਭੰਗੜ ਜੀਆਂ ਨੂੰ ਬਹੁਤ ਆਕਰਸ਼ਕ ਬਣਾ ਦਿੰਦਾ ਹੈ ਤੇ ਉਹਨਾਂ ਦੀ ਦਿੱਖ ਬਹੁਤ ਖੂਬਸੂਰਤ ਹੋ ਜਾਂਦੀ ਹੈ